ਹਾਂਜੀ ਸਤਿ ਸ਼੍ਰੀ ਅਕਾਲ ਜੀ ਏਅਰਟੈੱਲ ਕਸਟਮਰ ਕੇਅਰ ਤੋਂ ਬੋਲਦੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਮੈਂ ਆਪਣੇ ਮੋਬਾਈਲ ਦਾ ਰੀਚਾਰਜ ਸੀ ਉਹ ਕਰਨਾ ਸੀ ਮੇਰਾ ਮੋਬਾਇਲ ਨੰਬਰ ਹੈ ਇਕਾਸੀ ਚਾਰ ਸੌ ਸਤਾਹਠ ਇਕਾਸੀ ਪੰਜ ਸੌ ਨੱਬੇ ਪਰ ਮੇਰੇ ਤੋਂ ਇਕਾਸੀ ਚਾਰ ਸੌ ਸਤਾਹਠ ਇਕਾਸੀ ਪੰਜ ਸੌ ਅਠਾਸੀ ਦੇ ਨੰਬਰ ਦੇ ਉੱਤੇ ਰੀਚਾਰਜ ਹੋ ਗਿਆ ਹੈ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਮੈਂ ਆਪਣੇ ਮੋਬਾਈਲ ਦਾ ਜਿਹੜਾ ਰੀਚਾਰਜ ਉਹ ਕਿਵੇਂ ਹਾਸਲ ਕਰਾਂ ਅਤੇ ਜਿਹੜੀ ਗਲਤੀ ਹੋਈ ਆ ਇਸਨੂੰ ਕਿਵੇਂ ਸੁਧਾਰ ਸਕਦੇ ਹਾਂ ਮੈਨੂੰ ਸਾਰਾ ਰੀਚਾਰਜ ਕਰਨ ਦਾ ਜਿਹੜਾ ਤਰੀਕਾ ਉਹ ਸਾਰਾ ਸਹੀ ਤਰੀਕੇ ਦੇ ਨਾਲ ਦੱਸਿਆ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ